ਹਾਂਜੀ ਸਤਿ ਸ਼੍ਰੀ ਅਕਾਲ ਜੀ

ਮੈਡਮ ਮਿਲ ਜੇਗਾ ਆਪਣਾ ਵੰਨ ਬੀ ਐੱਚ ਕੇ ਫਲੈਟ ਹੈਗਾ ਜੇ ਪਾਰਵਤੀ ਹੋਸਪੀਟਲ ਦੇ ਬੈਕ ਸਾਈਡ ਉੱਤੇ ਏ ਬਲੋਕ 'ਚ ਅਤੇ ਫੁਲੀ ਫਰਨਿਸ਼ਡ ਹੈਗਾ ਜੇ ਆਪਣਾ ਉੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਮੋਟਰ ਮੂਟਰ ਲੱਗੀ ਹੋਈ ਜੇ ਆਪਣਾ ਫਰਨੀਚਰ ਵੀ ਸਾਰਾ ਸੋਫਾ ਸੂਫਾ ਬੈੱਡ ਬੁੱਡ ਤੁਹਾਨੂੰ ਵਿੱਚੇ ਮਿਲ ਜੇਗਾ ਸਭ ਕੁਛ ਉਹ ਦਸ ਹਜ਼ਾਰ ਰੁਪਈਆ ਰੈਂਟ ਹੈਗਾ ਜੀ ਉੱਥੇ ਦਾ ਅਤੇ ਤੁਹਾਨੂੰ ਐਗਰੀਮੈਂਟ ਜਿਹੜਾ ਹੈਗਾ ਵਾ ਸਾਲ ਦਾ ਅਤੇ ਘੱਟੋ ਘੱਟ ਕਰਨਾ ਪਏਗਾ ਅਤੇ ਜੇ ਤੁਸੀਂ ਕਹੋਗੇ ਤਾਂ ਆਪਾਂ ਛੇ ਸਾਲ ਦਾ ਵੀ ਇਕੱਠਾ ਕਰਵਾ ਸਕਦੇ ਜੇ ਤਾਂ ਤੁਸੀਂ ਇਸ ਤਰ੍ਹਾਂ ਕਰਿਓ ਸ਼ਾਮ ਨੂੰ ਨਾ ਇੱਕ ਵਾਰੀ ਆ ਕੇ ਮੈਨੂੰ ਉੱਥੇ ਰਣਜੀਤ ਐਵੇਨਿਊ ਬੀ ਬਲੋਕ 'ਚ ਮਿਲ ਲਉ ਮੇਰੇ ਦਫ਼ਤਰ ਠੀਕ ਹੈ ਜੀ ਚਲੋ ਓਕੇ ਬਾਏ